ਪਿੱਠ ਦੇ ਦਰਦ ਨੂੰ ਠੀਕ ਕਰਨ ਲਈ ਵੈਸੇ ਤਾਂ ਬੜੇ ਹੀ ਨੁਸਖੇ ਹਨ ਪਰ ਸਾਡੇ ਪਿੰਡ ਵਿੱਚ ਕਈ ਘਰੇਲੂ ਨੁਸਖਿਆਂ ਨਾਲ ਇਸ ਦਰਦ ਨੂੰ ਠੀਕ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਜਿਸ ਵਿਅਕਤੀ ਨੂੰ ਪਿੱਠ ਦੀ ਦਰਦ ਹੈ ਉਸ ਨੂੰ ਬਿਨਾ ਗੱਦੇ ਤੋਂ ਹਾਰਡ ਬੋਰਡ ਵਾਲੇ ਮੰਜੇ ਉੱਤੇ ਸੌਣ ਲਈ ਕਿਹਾ ਜਾਂਦਾ ਹੈ ਜਿਸ ਨਾਲ ਉਸਦੀ ਪਿੱਠ ਨੂੰ ਝੋਲ ਨਾ ਪਵੇ ਅਤੇ ਆਰਾਮ ਮਿਲੇ ਪਿੱਠ ਨੂੰ ਕਈ ਗਰਮ ਤੇਲ ਅਲਸੀ ਦਾ ਤੇਲ ਤਿਲਾਂ ਦਾ ਤੇਲ ਦੀ ਮਾਲਿਸ਼ ਵੀ ਕੀਤੀ ਜਾਂਦੀ ਹੈ ਗਰਮ ਪੱਟੀਆਂ ਦੀ ਵਰਤੋਂ ਦੇ ਨਾਲ ਵੀ ਪਿੱਠ ਨੂੰ ਆਰਾਮ ਆ ਜਾਂਦਾ ਹੈ ਲੂਣ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਇੱਕ ਕੱਪੜੇ ਵਿੱਚ ਬੰਨ੍ਹ ਕੇ ਉਸ ਦੀ ਟਕੋਰ ਵੀ ਪਿੱਠ ਨੂੰ ਕੀਤੀ ਜਾਂਦੀ ਹੈ ਗਰਮ ਪਾਣੀ ਦੀਆਂ ਬੋਤਲਾਂ ਦੇ ਨਾਲ ਵੀ ਪਿੱਠ ਦੇ ਦਰਦ ਨੂੰ ਦੂਰ ਕੀਤਾ ਜਾਂਦਾ ਹੈ ਘਰ ਵਿੱਚ ਕਿਸੇ ਵੀ ਨੁੱਕਰ ਦੇ ਉੱਪਰ ਅੱਗੇ ਖੜ੍ਹੇ ਹੋ ਕੇ ਆਪਦੇ ਆਪ ਨੂੰ ਪਿੱਛੇ ਧੱਕਾ ਦੇ ਕੇ ਪਿੱਠ ਦੇ ਦਰਦ ਨੂੰ ਦੂਰ ਕਰ ਸਕਦੇ ਹਾਂ ਇਸ ਤਰ੍ਹਾਂ ਹੋਰ ਵੀ ਬਥੇਰੇ ਨੁਸਖੇ ਹਨ ਕਈ ਤਰ੍ਹਾਂ ਦੀਆਂ ਯੋਗੇ ਯੋਗਾ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਅਭਿਆਸ ਕਰਵਾਏ ਜਾਂਦੇ ਹਨ ਜਿਸ ਨਾਲ ਪਿੱਠ ਨੂੰ ਕਾਫੀ ਫਰਕ ਪੈਂਦਾ ਹੈ

ਨੁਸਖੇ ਇਹੋ ਜਿਹੇ ਹਨ ਜਿਹੜੇ ਖਾਣ ਪੀਣ ਨਾਲ ਸੰਬੰਧਿਤ ਹਨ ਆਟਾ ਵੇਸਣ ਦੇ ਨਾਲ ਕਈ ਗਰਮ ਚੀਜ਼ਾਂ ਜਿਹਨਾਂ ਨੂੰ ਸਰੀਰ ਵਿੱਚ ਤਾਕਤ ਆਉਂਦੀ ਹੈ ਪਵਾ ਕੇ ਆਦਮੀ ਨੂੰ ਖਾਣ ਨੂੰ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਪਿੱਠ ਨੂੰ ਆਰਾਮ ਮਿਲਦਾ ਹੈ